ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਤੁਹਾਡੇ ਨਾਲ ਘਰ ਬਾਰੇ ਤੁਸੀਂ ਪ੍ਰੋਪਰਟੀ ਡੀਲਰ ਵਾਲੇ ਬੋਲਦੇ ਹੋ ਹਾਂਜੀ ਮੈਂ ਤੁਹਾਡੇ ਨਾਲ ਘਰ ਵਾਲੀ ਗੱਲ ਕੀਤੀ ਸੀ ਨਾ ਕਿ ਅਸੀਂ ਘਰ ਲੈਣਾ ਹਾਂ ਤੇ ਕਿੱਦਾਂ ਹੈਗਾ ਤੁਸੀਂ ਕੁਛ ਹਾਂਜੀ ਹਾਂਜੀ ਅੱਛਾ ਅਤੇ ਉਹ ਫਿਰ ਵੀ ਕਿਹੜੀ ਸਾਈਡ ਨੂੰ ਆ ਕ ਕਿੱਧਰ ਆ ਸਾਨੂੰ ਦੂਰ ਵੀ ਨਾ ਪਵੇ ਅਸੀਂ ਅੱਡੇ ਦੇ ਲਾਗੇ ਰਹਿੰਦੇ ਹਾਂ ਹੈ ਨਾ

ਠੀਕ ਆ ਮਤਲਬ ਪੋਰਸ਼ਨ ਕਿਸ ਤਰ੍ਹਾਂ ਦਾ ਡਬਲ ਸਟੋਰੀ ਵਾਲਾ ਕਿ ਦੂਸਰੇ ਆ ਕਿਵੇਂ ਕਿਵੇਂ ਕਿੰਨੇ ਘਰ ਆ ਮਤਲਬ ਜਿਹੜੇ ਤੁਸੀਂ ਦੇਖੇ ਆ ਕਿ ਅਸੀਂ ਫਿਰ ਮੈਂ ਆਪਣੇ ਹਸਬੈਂਡ ਨਾਲ ਗੱਲ ਕਰੂੰਗੀ ਹੈ ਨਾ ਪਹਿਲਾਂ ਮੈਨੂੰ ਦੱਸ ਦਿਓ ਕਿ ਡਬਲ ਸਟੋਰੀ ਹੈ ਕਿ ਸਿੰਗਲ ਸਟੋਰੀ ਵਾਲੇ ਆ ਹੈ ਨਾ ਪੋਰਸ਼ਨ ਆ ਹਾਂਜੀ ਹੁੰ ਹੁੰ ਅੱਛਾ ਠੀਕ ਹੈ ਠੀਕ ਹੈ ਬਸ ਇਹ ਹੀ ਆ ਕਿ ਹਾਂਜੀ ਜਿਹੜਾ ਦੂਸਰਾ ਹਾਂਜੀ ਠੀਕ ਆ ਆ ਓਕੇ ਆਪਾਂ ਫੈਮਲੀ ਦੇ ਅਕੋਰਡਿੰਗ ਵੀ ਲੈਣਾ ਹੈ ਨਾ ਅਤੇ ਵੀ ਹੋਵੇ ਫੈਮਲੀ ਦੇ ਅਕੋਰਡਿੰਗ ਵੀ ਹੋਵੇ ਕਿ ਕਿੰਨੇ ਕੁ ਫੈਮਲੀ ਆ ਬਸ ਉਹ ਵਿੱਚ ਆਪਾਂ ਨੂੰ ਦੋ ਕਮਰੇ ਅਤੇ ਲੋਬੀ ਮਤਲਬ ਇਹਦੀ ਚੱਲ ਸਕਦਾ ਵਿੱਚ ਸਟੋਰ ਰੂਮ ਜ਼ਰੂਰੀ ਆ ਹੈ ਨਾ ਅਤੇ ਹਾਂ ਹਾਂ ਹਾਂਜੀ ਕਿੰਨਾ ਫਿਰ ਵੀ ਤੁਸੀਂ ਫਿਰ ਜਿਹੜਾ ਛੋਟੇ ਵਾਲਾ ਇਹ ਕਿੰਨੇ ਹੈਗਾ ਲੱਖ ਦਾ ਅੱਛਾ ਮਤਲਬ ਸਾਰਾ ਕੰਪ ਹੋਇਆ ਅਨਕੰਪਲੀਟ ਤਾਂ ਨਹੀਂ ਗਾ ਕਿ ਜਿਵੇਂ ਆਪਾਂ ਸਾਢੇ ਪੰਜ ਦੇ ਵਿੱਚ ਮਤਲਬ ਫਿਰ ਵੀ ਕੱਪਬੋਰਡ ਵਗੈਰਾ ਲੱਗੇ ਵੇ ਆ ਸਾਢੇ ਪੰਜ ਦੇ ਵਿੱਚ ਠੀਕ ਹੈ ਮਤਲਬ ਕੱਪਬੋਰਡ ਵਗੈਰਾ ਕਿਚਨ ਦੇ ਸਾਰੇ ਪਾਉਣੇ ਪੈਣੇ ਆ ਸਾਨੂੰ ਲੱਕੜ ਦਾ ਕੰਮ ਅੱਛਾ ਸਾਢੇ ਪੰਜ ਲੱਖ ਦਾ ਹੈ ਨਾ ਅਤੇ ਜਿਹੜਾ ਹੁੰ ਹੁੰ ਹੁੰ ਹੁੰ ਹੁੰ ਹਾਂ ਫਿਰ ਵੈਸੇ ਜਿਵੇਂ ਹੁਣ ਦੇਖਿਆ ਜਾਵੇ ਦੇਖ ਕੇ ਬਾਕੀ ਪਤਾ ਲੱਗੂਗਾ ਮੈਂ ਆਪਣੇ ਹਸਬੈਂਡ ਨਾਲ ਗੱਲ ਕਰੂੰਗੀ ਅਤੇ ਵੈਸੇ ਮੈਨੂੰ ਜਿਹੜਾ ਤੁਸੀਂ ਆ ਹੁਣ ਡਬਲ ਸਟੋਰੀ ਦੱਸਿਆ ਇਹ ਮੈਨੂੰ ਥਾਂ ਥੋੜ੍ਹਾ ਜਿਹਾ ਮੈਨੂੰ ਆਪਣੇ ਹਿਸਾਬ ਨਾਲ ਵਧੀਆ ਲੱਗਦਾ ਅਤੇ ਜਿਹੜਾ ਛੋਟਾ ਉਹ ਫਿਰ ਵੀ ਸਿੰਗਲ ਆ ਹੈ ਨਾ ਕੋਈ ਗੈਸਟ ਵਗੈਰਾ ਆ ਜਾਂਦਾ ਕਮਰੇ ਹੋਣੇ ਚਾਹੀਦੇ ਆ ਅਤੇ ਚਲੋ ਮੈਂ ਵੇਖਦੀ ਹਾਂ ਤੇ ਮੇਰੀ ਗੱਲ ਸੁਣੋ ਇੱਕ ਤੁਸੀਂ ਨਾ ਹੋਰ ਵੀ ਮੈਨੂੰ ਤੁਸੀਂ ਹੋਰ ਕਲੋਨੀਆਂ ਦੇ ਵਿੱਚ ਮਤਲਬ ਗੱਲ ਕਰ ਦੇਖ ਦੇਖ ਲਿਓ ਮਤਲਬ ਲਾਗੇ ਛਾਗੇ ਹੋਵੇ ਕੀ ਆਪਾਂ ਨੂੰ ਜ਼ਰੂਰੀ ਨਹੀਂ ਆਪਾਂ ਮੁਹੱਲੇ 'ਚ ਵੀ ਲੈ ਸਕਦੇ ਹਾਂ

ਹਾਂ ਹਾਂ

ਨਹੀਂ ਉਹ ਨਾ ਜਿਵੇਂ ਹੁਣ ਪਹਿਲਾਂ ਅਸੀਂ ਦੇਖ ਲਾਂਗੇ ਘਰ ਹੈ ਨਾ ਉਸ ਤੋਂ ਬਾਅਦ ਆਪਾਂ ਯਾਨੀ ਕਿ ਮੈਂ ਆਵਾਂਗੀ ਕੋਈ ਸ਼ਾਮੀ ਆਵਾਂਗੀ ਇਹਨਾਂ ਨਾਲ ਗੱਲ ਕਰੂੰਗੀ ਅਤੇ ਤੁਹਾਡੇ ਕੋਲ ਆਵਾਂਗੇ ਹੈ ਨਾ ਉਸ ਤੋਂ ਬਾਅਦ ਆਪਾਂ ਯਾਨੀ ਕਿ ਦੇਖਾਂਗੇ ਕੀ ਡਿਸਾਈਡ ਕਰਾਂਗੇ ਦੋਨੇ ਘਰ ਪਹਿਲਾਂ ਇਹ ਵੇਖ ਲਈਏ ਅੱਡੇ ਦੇ ਲਾਗੇ ਵਾਲੇ ਫਿਰ ਚਲੋ ਬਾਬਾ ਫਰੀਦ ਜੀ ਦੇ ਕੋਲ ਯਾਨੀ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਹੈ ਨਾ ਅਤੇ ਉਦੋਂ ਤੱਕ ਆਪਾਂ ਇਹ ਦੇਖ ਲਾਂਗੇ ਅਤੇ ਆਪਾਂ ਨਾਲ ਮੈਂ ਆਪਣਾ ਨਾ ਬੱਚਿਆਂ ਨਾਲ ਗੱਲ ਕਰ ਲੂੰਗੀ ਹੈ ਨਾ ਹਾਂ ਨਹੀਂ ਪਰ ਪਤਾ ਕੀ ਆ ਜਿਵੇਂ ਆਪਾਂ ਨੂੰ ਇੱਕ ਚੀਜ਼ ਇੱਕ ਵਾਰ ਬਣਦੀ ਆ ਹੈ ਨਾ ਇਹ ਘਰ ਵਗੈਰਾ ਤਾਂ ਇੱਕ ਵਾਰ ਬਣਦਾ ਹੁਣ ਹਾਂ ਅਤੇ ਜੇ ਆਪਾਂ ਪੈਸਿਆਂ ਦੇ ਤੁਹਾਨੂੰ ਹੀ ਆਪਾਂ ਕਰੀ ਜਾਵਾਂਗੇ ਆਪਣੇ ਕੋਲ ਪੈਸੇ ਹੈ ਨਹੀਂ ਆਪਾਂ ਫਿਰ ਨਹੀਂ ਮਾ ਮਤਲਬ ਵਧੀਆ ਚੀਜ਼ ਲਈਏ ਅਤੇ ਬੱਚੇ ਪਿੱਛੋਂ ਵੀ ਨਾ ਤੰਗ ਹੋਣ ਦੋ ਸਾਲਾਂ ਬਾਅਦ ਭਲਾ ਢੱਠਾ ਲੱਗ ਜੇ ਵੀ ਨਹੀਂ ਚੰਗੀ ਗੱਲ ਤਾਂ ਪੂਰਾ ਪ੍ਰੋਫੈਕਟ ਲੈਣਾ ਕਿ ਪੂਰਾ ਕਿ ਵਧੀਆ ਹੋਵੇ ਉਹਦੀ ਜਿਹੜੀ ਮਟੀਰੀਅਲ ਲੱਗਿਆ ਉਹ ਵੀ ਅੱਛਾ ਹੋਵੇ ਹੈ ਨਾ ਅਤੇ ਪਾਣੀ ਪੂਣੀ ਨਾ ਬਸ ਵੜਦਾ ਹੋਵੇ ਯਾਨੀ ਕਿ ਆਪਾਂ ਨੂੰ ਥੋੜ੍ਹਾ ਜਿਹਾ ਇਹ ਹੁੰਦਾ ਤਾਂ ਕਿ ਰੁਕੇ ਰਾਕੇ ਨਾ ਛੱਤਾਂ 'ਤੇ ਹੁੰ ਹੁੰ ਹਾਂ ਹੁੰ ਹੁੰ ਹਾਂਜੀ ਹਾਂਜੀ ਹਾਂਜੀ ਕੋਈ ਨਹੀ ਮੈਂ ਆਵਾਂਗੀ ਸ਼ਾਮੀ ਠੀਕ ਹੈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ